ਯੋਗਾ ਕਰਨ ਦੀ ਕੋਈ ਫਿਕਸ ਉਮਰ ਨਹੀਂ ਹੁੰਦੀ ਇਹ ਮਤਲਬ ਅਸੀਂ ਕਿਸੇ ਵੀ ਉਮਰ 'ਚ ਕਰ ਸਕਦੇ ਹਨ ਮਤਲਬ ਪੰਜ ਤੋਂ ਪੰਜ ਤੋਂ ਲੈ ਕੇ ਸੱਠ ਸਾਲ ਦੇ ਵਿੱਚ ਵਿੱਚ ਇਹ ਯੋਗਾ ਅਸੀਂ ਕਰ ਸਕਦੇ ਹਨ ਅਤੇ ਇਸ ਦੇ ਸਾਨੂੰ ਕਈ ਬੈਨਫਿਟ ਨੇ ਜੇ ਅਸੀਂ ਆਪਣੇ ਬੱਚਿਆਂ ਨੂੰ ਸਟਾਰਟਿੰਗ ਤੋਂ ਯੋਗਾ ਸਿਖਾਈਏ ਤਾਂ ਉਹ ਬੱਚਾ ਕਾਫੀ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਅਤੇ ਉਸਦਾ ਮਾਈਂਡ ਵੀ ਸ਼ਾਰਪ ਰਹਿੰਦਾ ਹੈ ਅਤੇ ਉਸਨੂੰ ਕੋਈ ਬਿਮਾਰੀ ਜਲਦੀ ਲੱਗਦੀ ਨਹੀਂ ਇਨ ਕੇਸ ਅਗਰ ਕੋਈ ਬਜ਼ੁਰਗ ਬੰਦੇ ਵੀ ਹਨ ਅਤੇ ਉਹ ਮੈਡੀਟੇਸ਼ਨ ਵਗੈਰਾ ਕਰਨ ਤਾਂ ਉਹਨਾਂ ਦੀ ਆਯੂ 'ਚ ਕਾਫੀ ਵਾਧਾ ਹੋ ਜਾਂਦਾ ਹੈ ਕਿਉਂਕਿ ਉਹ ਕਈ ਤਰ੍ਹਾਂ ਦੀ ਬਿਮਾਰੀ ਨੂੰ ਝੇਲਦੇ ਹੁੰਦੇ ਹਨ ਬੁਢਾਪੇ 'ਚ ਅਤੇ ਮੈਡੀਟੇਸ਼ਨ ਨਾਲ ਉਹਨਾਂ ਨੂੰ ਉਸ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਆ ਜਾਂਦੀ ਹੈ ਅਤੇ ਮੈਡੀਟੇਸ਼ਨ ਦਾ ਸਾਡੀ ਲਾਈਫ 'ਚ ਹੋਰ ਵੀ ਯੋਗਦਾਨ ਹੈ ਜਿਵੇਂ ਕਿ ਅਸੀਂ ਅਨਲੋਮ ਬਲੋਂਗ ਕਰੀਏ ਜਿਹਦੇ 'ਚ ਅਸੀਂ ਇੱਕ ਨੱਕ ਤੋਂ ਸਾਹ ਲੈ ਕੇ ਦੂਏ ਨੱਕ ਚੋਂ ਛੱਡੀਏ ਤਾਂ ਉਸ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਡੀਆਂ ਠੀਕ ਹੋ ਜਾਂਦੀ ਜਿਵੇਂ ਕਿ ਮੈਡੀਟੇਸ਼ਨ ਜਿੱਦਾਂ ਸਾਨੂੰ ਡਿਪਰੈਸ਼ਨ ਦੀ ਬਿਮਾਰੀ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ ਹੋਰ ਵੀ ਕਈ ਸਮੱਸਿਆਵਾਂ ਉਹਦੇ ਨਾਲ ਠੀਕ ਹੋ ਜਾਂਦੀਆਂ ਹਨ ਇਸ ਤੋਂ ਇਲਾਵਾ ਅਸੀਂ ਕਪਾਲਭਾਤੀ ਯੋਗਾ ਕਰੀਏ ਉਸ ਨਾਲ ਵੀ ਸਾਨੂੰ ਪੇਟ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਉਸ ਤੋਂ ਇਲਾਵਾ ਹੋਰ ਵੀ ਕਈ ਆਸਨ ਨੇ ਜਿਹਨੂੰ ਕਰਕੇ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਨ